ਕੀੜੇ ਮਕੌੜੇ ਦੇ ਢੰਗਾਂ ਨੂੰ ਆਰਾਮ ਦੇਣ ਲਈ ਘਰੇਲੂ ਉਪਚਾਰਕ ਅਕਸਰ ਪ੍ਰਭਾਵਸ਼ਾਲੀ ਅਤੇ ਵਰਤੋਂ ਵਿੱਚ ਆਸਾਨ ਹੁੰਦੇ ਹਨ ਸਟਿੰਗ ਵਾਲੀ ਥਾਂ ਤੇ ਹੋਲਡ ਕਪੈਸਰੈਸ ਜਾਂ ਆਈਸੈਕ ਲਗਾਉਣ ਨਾਲ ਸੋਜ ਘੱਟ ਜਾਂਦੀ ਹੈ ਦਰਦ ਸੁੰਨ ਹੋ ਜਾਂਦਾ ਹੈ ਬੇਕਿੰਗ ਸੋਡਾ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾਉਣ ਜਹਿਰੀ ਨੂੰ ਬੇਅਸਰ ਕਰ ਸਕਦਾ ਹੈ ਅਤੇ ਖੁਜਲੀ ਨੂੰ ਦੂਰ ਕਰਦਾ ਹੈ ਇਹ ਓਵਰ ਦੀ ਕਾਊਂਟਰ ਹਾਈਡਰੋਕਸਾਈਡ ਕਰੀਮ ਦੀ ਖੁਜਲੀ ਅਤੇ ਸੋਜ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੀ ਹੈ ਐਲੋਵੀਰਾ ਜੈਲ ਇਸਦੇ ਆਰਾਮਦਾਇਕ ਗੁਣਾਂ ਦੇ ਨਾਲ ਦਰਦ ਤੋਂ ਰਾਹਤ ਪ੍ਰਦਾਨ ਕਰ ਸਕਦਾ ਹੈ ਅਤੇ ਇਲਾਜ ਨੂੰ ਤੇਜ ਕਰ ਸਕਦਾ ਹੈ ਇੱਕ ਕੁਦਰਤੀ ਜੜ ਵਿਰੋਧ ਪ੍ਰਭਾਵ ਲਈ ਸ਼ਹਿਦ ਨੂੰ ਲਗਾਉਣਾ ਜਿਸ ਵਿੱਚ ਅਰਾਮਦਾਇਕ ਅਤੇ ਰੋਗਾਂ ਨੂੰ ਨਾਸ਼ਕ ਦੋਵੇਂ ਗੁਣ ਹੁੰਦੇ ਹਨ ਜਲਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਜਰੂਰੀ ਤੇਲ ਜਿਵੇਂ ਚਾਹ ਦੇ ਰੁੱਖ ਦਾ ਤੇਲ ਦਾ ਲੈਵੈਂਡਰ ਤੇਲ ਜਦੋਂ ਕੈਰੀਅਰ ਤੇਲ ਨਾਲ ਪੇਤਲੀ ਪੈ ਜਾਂਦਾ ਹੈ ਖੁਜਲੀ ਨੂੰ ਘਟਾ ਸਕਦਾ ਹੈ ਅਤੇ ਲਾਗ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਕੁਚਲਿਆ ਐਪ੍ਰੀਨ ਤੋਂ ਬਣਿਆ ਪੇਸਟ ਇਸ ਦੇ ਸਾੜ ਵਿਰੋਧੀ ਗੁਣਾਂ ਦੇ ਕਾਰਨ ਦਰਦ ਅਤੇ ਜਲੂਣ ਨੂੰ ਦੂਰ ਕਰਦਾ ਹੈ ਅੰਤ ਵਿੱਚ ਸਟਿੰਗ ਖੇਤਰ ਨੂੰ ਸਾਫ ਰੱਖਣਾ ਅਤੇ ਖੁਰਕਣ ਤੋਂ ਬਚਣਾ ਬਚਾਉਣ ਲਈ ਰੋਕ ਸਕਦਾ ਹੈ ਅਤੇ ਜਲਦੀ ਠੀਕ ਹੋਣ ਵਿੱਚ ਸਹਾਇਤਾ ਕਰਦਾ ਹੈ